ਮਨੁੱਖ ਹਮੇਸ਼ਾਂ ਆਪਣੀਆਂ ਜੜ੍ਹਾਂ ਨਾਲ ਜੁੜਨਾ ਚਾਹੰਦਾ ਹੈ ਜਿਹੜੀ ਕਿ ਹਰ ਇੱਕ ਬੰਦੇ ਵਾਸਤੇ ਉਸਦੇ ਆਪਣੇ ਤੌਰ 'ਤੇ ਗੱਲ ਸਹੀ ਹੈ ਸਾਨੂੰ ਹਮੇਸ਼ਾਂ ਹੀ ਆਪਣੇ ਵਰਗਾ ਬੰਦਾ ਅਸੀਂ ਲੱਭਣ ਜਾਂਦੇ ਹਾਂ ਦੁਨੀਆਂ 'ਚ ਜਿਹੜਾ ਕਿ ਅੱਜ ਕੱਲ੍ਹ ਦੇ ਯੁੱਗ ਵਿੱਚ ਬਹੁਤ ਮੁਸ਼ਕਿਲ ਹੈ ਸੋ ਇਸ ਚੀਜ਼ ਨੂੰ ਬੈਲੰਸ ਕਰਨ ਲਈ ਜਾਂ ਮੇਨ ਕਰਨ ਲਈ ਸਾਨੂੰ ਹਮੇਸ਼ਾਂ ਇਹ ਗੱਲ ਯਾਦ ਰੱਖਣੀ ਪੈਂਦੀ ਹੈ ਕਿ ਜਿਵੇਂ ਵੀ ਅਸੀਂ ਸੋਚਦੇ ਹਾਂ ਜਾਂ ਅਸੀਂ ਸਮਝਦੇ ਹਾਂ ਅਸੀਂ ਕਿਸੇ ਨੂੰ ਉਸ ਵਰਗਾ ਸਮਝਦੇ ਹਾਂ ਕਿ ਜਿਵੇਂ ਉਹ ਹੈਗਾ ਉਹ ਸਹੀ ਹੈ ਜਾਂ ਉਹ ਗਲਤ ਹੈ ਅਸੀਂ ਕਿਸੇ ਨੂੰ ਵੀ ਜਜਮੈਂਟ ਨਹੀਂ ਕਰ ਸਕਦੇ ਸੋ ਮੈਨੂੰ ਜੇ ਆਪਣੀ ਗੱਲ ਕਰਾਂ ਤਾਂ ਮੈਨੂੰ ਇਹ ਲੱਗਦਾ ਹੈ ਕਿ ਜਿੰਨਾ ਵੀ ਐਕਸਪੀਰੀਅੰਸ ਹੈ ਮੇਰਾ ਜਾਂ ਜਿੰਨਾ ਵੀ ਤਜ਼ਰਬਾ ਹੈ ਮੇਰਾ ਤਜ਼ਰਬਾ ਤਾਂ ਇਹ ਕਹਿੰਦਾ ਹੈ ਕਿ ਸਾਨੂੰ ਆਪਣੇ ਨਾਲ ਮਤਲਬ ਰੱਖਣ ਚਾਹੀਦਾ ਹੈ ਦੁਨੀਆਂ ਕੀ ਕਰ ਰਹੀ ਹੈ ਜਾਂ ਕੀ ਨਹੀਂ ਕਰ ਰਹੀ ਹੈ ਸਾਨੂੰ ਇਸ ਨਾਲ ਕੋਈ ਮਤਲਬ ਨਹੀਂ ਹੋਣਾ ਚਾਹੀਦਾ ਸੋ ਇਹੀ ਇੱਕ ਯਾਦ ਹੈ ਜੋ ਮੈਂ ਅੱਜ ਇਹ ਪਾਲਦਾ ਹਾਂ ਜਾਂ ਸਿੱਖਿਆ ਹਾਂ ਦੁਨੀਆਂ ਦੇ ਤਜ਼ਰਬੇ ਤੋਂ